ਹਾਂਜੀ ਸ਼ਹਿਰਾਂ ਦੇ ਵਿੱਚ ਜਾਂ ਕਸਬਿਆਂ ਦੇ ਵਿੱਚ ਬਾਲ ਮਜ਼ਦੂਰੀ ਕਾਫ਼ੀ ਹੁੰਦੀ ਹੈ ਕਿਉਂਕਿ ਜਿਹੜੇ ਬੱਚੇ ਨੇ ਉਹ ਪੂਅਰ ਸੋਸਾਇਟੀਜ ਨੂੰ ਗਰੀਬ ਘਰਾਂ ਦੇ ਬੱਚੇ ਨੇ ਅਤੇ ਉਹਨਾਂ ਦੇ ਘਰ ਦੇ ਵਿੱਚ ਇੰਨੇ ਮਸਲੇ ਹੁੰਦੇ ਨੇ ਕਿ ਫਿਰ ਉਹਨਾਂ ਨੂੰ ਕੰਮ ਜਿਹੜੇ ਉਹ ਕਰਨੇ ਪੈਂਦੇ ਆਪਣੇ ਘਰ ਨੂੰ ਸਪੋਰਟ ਕਰਨ ਲਈ ਆਪਣੇ ਘਰਦਿਆਂ ਨੂੰ ਹੋਣੀ ਤਾਂ ਨਹੀਂ ਚਾਹੀਦੀ ਕਿਉਂਕਿ ਇਹ ਜਿਹੜਾ ਹੈਗਾ ਜੇ ਗੌਰਮੈਂਟ ਆਪਣੇ ਕੰਮ ਜਿਹੜੇ ਉਹ ਸਹੀ ਤਰੀਕੇ ਨਾਲ ਕਰੇ ਗੌਵਮੈਂਟ ਹਰ ਫੈਸਿਲਿਟੀਜ਼ ਜਿਹੜੀਆਂ ਸਾਰਿਆਂ ਨੂੰ ਦਵੇ ਤਾਂ ਫਿਰ ਸ਼ਾਇਦ ਇਸ ਨੂੰ ਰੋਕਿਆ ਜਾ ਸਕਦਾ ਜ਼ਿਆਦਾਤਰ ਨੌਕਰੀਆਂ ਜਿਹੜੀਆਂ ਹੈਗੀਆਂ ਨੇ ਜਿਨ੍ਹਾਂ ਦੇ ਵਿੱਚ ਬੱਚੇ ਖਿੱਚੇ ਜਾਂਦੇ ਨੇ ਮੋਸਟਲੀ ਲੇਬਰ ਹੀ ਹੈ ਕਿ ਕਿਸੇ ਦੁਕਾਨ 'ਤੇ ਲੱਗ ਗਏ ਬਰਤਨ ਸਾਫ਼ ਕਰਨ ਦੇ ਲਈ ਜਾਂ ਝਾੜੂ ਮਾਰਨ ਲਈ ਜਾ ਟੇਬਲ ਸਾਫ਼ ਕਰਨ ਦੇ ਲਈ ਤੋ ਲੇਬਰ ਵਾਲੀ ਜਿਹੜੀ ਕਲਾਸ ਹੈ ਛੋਟੀਆਂ ਛੋਟੀਆਂ ਸ਼ੋਪਸ ਜਿੱਦਾਂ ਸਾਈਕਲਾਂ ਵਾਲੀ ਸ਼ੋਪ 'ਤੇ ਹੋ ਗਏ ਜਾਂ ਜਿੱਥੇ ਕੋਈ ਖਾਣ ਪੀਣ ਵਾਲੀ ਸ਼ੋਪ ਹੈਗੀ ਆ ਉੱਥੇ ਇਹ ਜ਼ਿਆਦਾਤਰ ਬੱਚੇ ਜਿਹੜੇ ਆ ਨੌਕਰੀਆਂ ਕਰਦੇ ਨੇ ਅਤੇ ਮੇਨ ਤਾਂ ਇਹ ਹੀ ਹੈ ਕਿ ਆਪਣੇ ਫੈਮਲੀ ਨੂੰ ਸਪੋਰਟ ਕਰਨ ਦੇ ਲਈ ਕਰਦੇ ਨੇ ਤੋ ਜੇ ਉਹਨਾਂ ਦੀਆਂ ਫੈਮਿਲੀਜ਼ ਨੂੰ ਅੱਛੀ ਜੋਬ ਮਿਲ ਸਕਦੀ ਹੈ ਕਿਤੇ ਨਾ ਕਿਤੇ ਤਾਂ ਫਿਰ ਉਹ ਜਿਹੜਾ ਹੈਗਾ ਇਹ ਚੀਜ਼ ਨੂੰ ਘੱਟ ਕੀਤਾ ਜਾ ਸਕਦਾ ਬਾਕੀ ਹਾਂ ਕਈ ਇਹ ਵੀ ਹੈਗੇ ਕਿ ਜਿੱਦਾਂ ਕੁਛ ਕਮਿਊਨਿਟੀਜ਼ ਇੱਦਾਂ ਦੀਆਂ ਨੇ ਜਿੱਦਾਂ ਜਿਹੜੇ ਲੋਕ ਬਿਹਾਰ ਤੋਂ ਆਉਂਦੇ ਯੂ ਪੀ ਤੋਂ ਆਉਂਦੇ ਆ ਉਹ ਕਹਿੰਦੇ ਕਿ ਅਸੀਂ ਆਪਣੇ ਬੱਚਿਆਂ ਨੂੰ ਨੌਕਰੀਆਂ ਕਰਾਉਣੀਆਂ ਹੀ ਕਰਾਉਣੀਆਂ ਨੇ ਜੀ ਸਾਨੂੰ ਫਾਇਦਾ ਹੁੰਦਾ ਤੋ ਕਈ ਮਾਂ ਪਿਓ ਜਿਹੜੇ ਨੇ ਉਹ ਆਪਣੇ ਫਾਇਦੇ ਦੇ ਲਈ ਉਹ ਬੱਚਿਆਂ ਨੂੰ ਜਿਹੜਾ ਹੈਗਾ ਉਹ ਇਹਨਾਂ ਦੁਕਾਨਾਂ ਦੇ ਉੱਤੇ ਭੇਜ ਦਿੰਦੇ ਨੇ ਤਾਂ ਕਿ ਉਹ ਕਮਾ ਸਕਣ ਅਤੇ ਉਹ ਖਰਚਾ ਪੂਰਾ ਹੋ ਸਕੇ ਉਹਨਾਂ ਦੀ ਫੈਮਲੀ ਦਾ ਕਿਉਂਕਿ ਉਹ ਜਿੱਦਾਂ ਗੌਵਮੈਂਟ ਦੀ ਸਕੀਮ ਹੈ ਕਿ ਦੋ ਹੀ ਬੱਚੇ ਹੋਣੇ ਚਾਹੀਦੇ ਬਟ ਉਹਨਾਂ ਦੀਆਂ ਫੈਮਲੀਜ਼ ਦੇ ਵਿੱਚੋਂ ਬੱਚੇ ਹੀ ਜਿਹੜੇ ਨੇ ਉਹ ਸੱਤ ਅੱਠ ਨੇ ਤਾਂ ਫਿਰ ਤਾਂ ਸਰਵਾਈਵਲ ਜਿਹੜਾ ਥੋੜ੍ਹਾ ਮੁਸ਼ਕਿਲ ਹੋ ਜਾਂਦਾ ਤੋ ਆਪਣੇ ਸਰਵਾਈਵਲ ਦੇ ਲਈ ਉਹ ਜਿਹੜਾ ਹੈ ਆਪਣੇ ਬੱਚਿਆਂ ਨੂੰ ਬਾਲ ਮਜ਼ਦੂਰੀ ਦੇ ਵਿੱਚ ਭੇਜਦੇ ਨੇ ਵੈਸੇ ਬਾਲ ਮਜ਼ਦੂਰੀ ਹੋਣੀ ਨਹੀਂ ਚਾਹੀਦੀ